ਜਿਵੇਂ ਕਿ ਮੇਰੀ ਜੋ ਹੋਬੀ ਹੈ ਉਹ ਡਰੋਇੰਗ ਅਤੇ ਆਰਟ ਐਂਡ ਕ੍ਰਾਫਟ ਹੈ ਅਤੇ ਮੈਨੂੰ ਅਲੱਗ ਅਲੱਗ ਤਰ੍ਹਾਂ ਦੇ ਲੈਂਡਸਕੇਪ ਜਾਂ ਫਿਰ ਕਾਰਟੂਨਸ ਬਣਾਉਣੇ ਬਹੁਤ ਪਸੰਦ ਨੇ ਮੈਂ ਜ਼ਿਆਦਾਤਰ ਆਪਣੇ ਡਰੋਇੰਗ ਦੇ ਆਈਡੀਆ ਜੋ ਨੇ ਉਹ ਗੂਗਲ ਤੋਂ ਲੈਂਦੀ ਹਾਂ ਗੂਗਲ 'ਤੇ ਜਿਹੜੀ ਵੀ ਫੋਟੋ ਮੈਨੂੰ ਪਸੰਦ ਆਉਂਦੀ ਹੈ ਉਸਦਾ ਤਕਰੀਬਨ ਹੂ ਬ ਹੂ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਬਹੁਤ ਸਾਰੇ ਤਰੀਕੇ ਦੇ ਰੰਗ ਜੋ ਹੈ ਉਸਦਾ ਯੂਸ ਕਰਕੇ ਮੈਂ ਆਪਣੇ ਹੱਥਾਂ ਨਾਲ ਕੋਈ ਵੀ ਤਸਵੀਰ ਬਣਾਉਣੀ ਹਾਂ ਡਰੋਇੰਗ ਸਿਰਫ ਮੇਰੀ ਹੋਬੀ ਹੀ ਨਹੀਂ ਮੇਰਾ ਇੱਕ ਸਟਰੈਸ ਬਸਟਰ ਵੀ ਹੈ ਜਿਵੇਂ ਕਿ ਕਈ ਵਾਰ ਪੜ੍ਹਾਈ ਦਾ ਜਾਂ ਫਿਰ ਕੁਝ ਹੋਰ ਚੀਜ਼ਾਂ ਦਾ ਦਿਮਾਗ 'ਤੇ ਬਹੁਤ ਹੀ ਤਨਾਵ ਜਾਂ ਫਿਰ ਸਟਰੈੱਸ ਹੁੰਦਾ ਹੈ ਤਾਂ ਜਦੋਂ ਮੈਂ ਡਰੋਇੰਗ ਕਰਦੀ ਹਾਂ ਉਸ ਨਾਲ ਉਹ ਸਟਰੈੱਸ ਜੋ ਹੈ ਉਹ ਹਲਕਾ ਹੋ ਜਾਂਦਾ ਦਿਮਾਗ ਸ਼ਾਂਤ ਹੋ ਜਾਂਦਾ ਹੈ ਅਤੇ ਜਦੋਂ ਇੱਕ ਵਧੀਆ ਜਿਹੀ ਡਰੋਇੰਗ ਜੋ ਹੈ ਉਹ ਮੈਂ ਬਣਾ ਕੇ ਆਪਣੇ ਦੋਸਤਾਂ ਨੂੰ ਜਾਂ ਫਿਰ ਪਰਿਵਾਰ ਨੂੰ ਦਿਖਾਉਂਦੀ ਹਾਂ ਅਤੇ ਉਹ ਮੇਰੀ ਤਾਰੀਫ ਕਰਦੇ ਹਨ ਉਸ ਨਾਲ ਮਨ ਬਹੁਤ ਖੁਸ਼ ਹੁੰਦਾ ਹੈ ਅਤੇ ਸਾਰੇ ਦਿਨ ਦੀ ਥਕਾਨ ਵੀ ਉਤਰ ਜਾਂਦੀ ਹੈ ਮੈਂ ਆਪਣੇ ਪੂਰੇ ਦਿਨ ਦੇ ਵਿੱਚ ਘੱਟ ਤੋਂ ਘੱਟ ਵੀਹ ਜਾਂ ਪੱਚੀ ਮਿੰਟ ਤਾਂ ਆਪਣੇ ਇਸ ਹੋਬੀ ਨੂੰ ਜ਼ਰੂਰ ਦੇਣ ਦੀ ਕੋਸ਼ਿਸ਼ ਕਰਦੀ ਹਾਂ ਭਾਵੇਂ ਕਿੰਨਾ ਹੀ ਬਿਜ਼ੀ ਦਿਨ ਹੋਵੇ ਘੱਟ ਤੋਂ ਘੱਟ ਵੀਹ ਜਾਂ ਪੱਚੀ ਮਿੰਟ ਮੈਂ ਡਰੋਇੰਗ ਜਾਂ ਕਲਰਿੰਗ ਲਈ ਜ਼ਰੂਰ ਕੱਢਣਾ ਪਸੰਦ ਕਰਦੀ ਹਾਂ ਅਤੇ ਮੈਂ ਲੋਕਾਂ ਨੂੰ ਵੀ ਇਹੀ ਸੁਜੈਸਟ ਕਰਦੀ ਹਾਂ ਕਿ ਉਹਨਾਂ ਦੀ ਜੋ ਵੀ ਹੋਬੀ ਹੋਵੇ ਉਹ ਉਸਨੂੰ ਰੋਜ਼ ਘੱ ਥੋੜ੍ਹਾ ਹੀ ਸਹੀ ਪਰ ਟਾਈਮ ਦੇਣ ਦੀ ਕੋਸ਼ਿਸ਼ ਕਰਨ ਕਿਉਂਕਿ ਆਪਣੀ ਜੋ ਹੋਬੀ ਹੈ ਉਸਨੂੰ ਜੇ ਤੁਸੀਂ ਰੋਜ਼ ਕਰੋਂਗੇ ਦੁਹਰਾਉਂਗੇ ਉਸ ਨਾਲ ਤੁਹਾਡਾ ਮਨ ਜੋ ਹੈ ਉਹ ਸ਼ਾਂਤ ਹੋਏਗਾ ਅਤੇ ਤੁਸੀਂ ਉਸ ਕਲਾ ਦੇ ਵਿੱਚ ਵੀ ਦਿਨ ਬ ਦਿਨ ਹੋਰ ਵਧੀਆ ਬਣਦੇ ਜਾਉਂਗੇ